ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮਨਪ੍ਰੀਤ ਬੋਲਦੇ ਜੀ ਹਾਂਜੀ ਜੀ ਮੈਂ ਤੁਹਾਡੇ ਇੱਥੋਂ ਨੇਬਰ ਤੋਂ ਹੀ ਬੋਲਦੀ ਪਈ ਹਾਂ ਜੀ ਹਾਂਜੀ ਜੀ ਮੈਂ ਤੁਹਾਨੂੰ ਪੁੱਛਣਾ ਸੀ ਜੀ ਕਿ ਸਾਡੇ ਨਾ ਫੰਕਸ਼ਨ ਹੈ ਹਾਂਜੀ ਅਤੇ ਇੱਥੇ ਸਿੰਗਰ ਕਿਹੜੇ ਮਿਲਣਗੇ ਅਸੀਂ ਬੁੱਕ ਕਰਨਾ ਕਿਸੇ ਸਿੰਗਰ ਨੂੰ ਆਪਣੇ ਫੰਕਸ਼ਨ 'ਤੇ ਬੁੱਕ ਕਰਨਾ ਚਾਹੁੰਦੇ ਹਾਂ ਤੁਸੀਂ ਮਿਊਜਿਕ ਪੜ੍ਹਾਉਂਦੇ ਹੋ ਨਾ ਤੁਸੀਂ ਮਿਊਜਿਕ ਕਲਾਸ ਹਾਂਜੀ ਹਾਂਜੀ ਬਸ ਜੀ ਹਾਂਜੀ ਉਹੀ ਪੁੱਛਣਾ ਸੀ ਕਿ ਤੁਸੀਂ ਕਿਸੇ ਸਿੰਗਰ ਨੂੰ ਜਾਣਦੇ ਹੋ ਅਸੀਂ ਬੁੱਕ ਕਰਨਾ ਚਾਹੁੰਦੇ ਹਾਂ ਮੈਰਿਜ਼ 'ਤੇ

ਹਾਂਜੀ ਹਾਂਜੀ ਹਾਂਜੀ ਨਾਮ ਤਾਂ ਸੁਣਿਆ ਹਾਂਜੀ ਪੇਮੈਂਟ ਕਿੰਨੇ ਕੁ ਲੈਂਦੇ ਨੇ ਦੱਸ ਸਕਦੇ ਹੋ ਕੁਛ ਆਈਡੀਆ ਹੈ ਤੁਹਾਨੂੰ ਹਾਂਜੀ ਠੀਕ ਹੈ ਜੀ ਮੈਂ ਤਾਂ ਤੁਸੀਂ ਕਰਵਾ ਸਕਦੇ ਹੋ ਲੈਸ ਉਹਨਾਂ ਕੋਲੋਂ ਥੋੜ੍ਹੇ ਅੱਛਾ ਜੀ ਠੀਕ ਹੈ ਜੀ ਮੈਂ ਨਾ ਤੁਹਾਨੂੰ ਡੇਟ ਦੱਸ ਦਾਂਗੀ ਕਿਸ ਦਿਨ ਦਾ ਕਰਨਾ ਅਤੇ ਤੁਸੀਂ ਪਲੀਜ਼ ਥੋੜ੍ਹਾ ਲੈਸ ਕਰਵਾ ਕੇ ਅਤੇ ਬੁਕਿੰਗ ਕਰਵਾ ਦਿਓ ਸਾਡੀ ਠੀਕ ਆ ਜੀ ਮੈਂ ਹਾਂਜੀ ਹਾਂਜੀ ਹਾਂਜੀ ਉਹੀ ਮੈਂ ਘਰਦਿਆਂ ਨਾਲ ਸਲਾਹ ਕਰਕੇ ਫਿਰ ਤੁਹਾਨੂੰ ਕੋਲ ਕਰਦੀ ਹਾਂ ਜੀ ਠੀਕ ਆ ਜੀ ਨਹੀਂ ਜੀ ਬਾਹਰ ਹੀ ਆ ਕਿਤੇ ਰੱਖਿਆ ਤਾਂ ਰਿਜੋਰਟ 'ਚ ਹੀ ਆ ਹਾਂਜੀ ਹਾਂਜੀ ਮੈਰਿਜ ਹੈ ਜੀ ਹਾਂਜੀ ਹਾਂਜੀ ਹਾਂਜੀ ਠੀਕ ਆ ਜੀ ਮੈਂ ਤੁਹਾਨੂੰ ਕਰਕੇ ਨਾ ਘਰਦਿਆਂ ਨਾਲ ਸਾਰੀ ਸਲਾਹ ਅਤੇ ਫਿਰ ਤੁਹਾਨੂੰ ਦੱਸਦੀ ਹਾਂ ਠੀਕ ਹੈ ਜੀ ਹਾਂਜੀ ਤੁਸੀਂ ਪਤਾ ਕਿੰਨਾਂ ਕੁ ਲੈਸ ਕਰਾ ਸਕਦੇ ਹੋ ਵੈਸੇ ਕੁਛ ਆਈਡੀਆ ਚਲੋ ਠੀਕ ਹੈ ਜੀ ਮੈਂ ਫਿਰ ਦੱਸਦੀ ਹਾਂ ਤੁਹਾਨੂੰ ਠੀਕ ਆ ਓਕੇ ਜੀ